ਮੈਂ ਔਨਲਾਈਨ ਬਜ਼ਾਜ਼ ਆਮਲਾ ਤੇਲ ਖਰੀਦਿਆ ਸੀ ਜੋ ਕਿ ਇਸਤੇਮਾਲ ਕਰਨ ਵਿੱਚ ਸ਼ੁਰੂ ਸ਼ੁਰੂਆਤ ਵਿੱਚ ਬਹੁਤ ਹੀ ਅੱਛਾ ਸੀਗਾ ਉਸ ਨਾਲ ਮੇਰੇ ਵਾਲ਼ ਜੋ ਹੈ ਕਾਫ਼ੀ ਸੰਘਣੇ ਹੋ ਗਏ ਸੀ ਅਤੇ ਉਹਨਾਂ ਦਾ ਝੜਨਾ ਵੀ ਬਹੁਤ ਘੱਟ ਹੋ ਗਿਆ ਸੀਗਾ ਅਤੇ ਇਹ ਤੇਲ ਯੂਜ਼ ਕਰਨ ਵਿੱਚ ਵੀ ਜੋ ਹੈ ਚਿਪਚਿਪਾ ਨਹੀਂ ਹੈ